ਪੰਜ ਲੱਖ ਪੰਤਾਲੀ ਹਜ਼ਾਰ ਛੇ ਸੌ ਵੀਹ ਨੌ ਲੱਖ ਤਰਤਾਲੀ ਹਜ਼ਾਰ ਸੱਤ ਸੌ ਵੀਹ ਅੱਠ ਲੱਖ ਤਿਹੱਤਰ ਹਜ਼ਾਰ ਚਾਰ ਸੌ ਪੰਤਾਲੀ ਸੱਤ ਲੱਖ ਵੀਹ ਹਜ਼ਾਰ ਸਾ ਚਾਰ ਸੌ ਪੱਚੀ ਚਾਰ ਲੱਖ ਪਚਵੰਜਾ ਹਜ਼ਾਰ ਸੱਤ ਸੌ ਉਨੱਤੀ